ਪੰਦਰਾਂ ਅਗਸਤ ਉੱਨੀ ਸੌ ਪੰਜਾਹ ਛੇ ਸਤੰਬਰ ਉੱਨੀ ਸੌ ਛਿਆਸੀ ਵੀਹ ਅਕਤੂਬਰ ਦੋ ਹਜ਼ਾਰ ਸੋਲ੍ਹਾਂ ਅਤੇ ਉਨੱਤੀ ਅਪ੍ਰੈਲ ਦੋ ਹਜ਼ਾਰ ਅਠਾਰਾਂ ਛੱਬੀ ਜਨਵਰੀ ਦੋ ਹਜ਼ਾਰ ਵੀਹ